ਹੈਲੋ ਮੈਂ ਅਰੁਣਾ ਬੋਲ ਰਹੀ ਹਾਂ ਸਤਿ ਸ਼੍ਰੀ ਅਕਾਲ ਜੀ ਇੱਥੇ ਨਾ ਸਾਡੇ ਪੰਜਾਬ ਦੇ ਵਿੱਚ ਬਹੁਤ ਹੈ ਵਾ ਇੱਥੇ ਕਿੰਨਾ ਨਹੀਂ ਬਹੁਤ ਵਧੀਆ ਜਗ੍ਹਾ ਦੇਖਣ ਵਾਲੀਆਂ ਘੁੰਮਣ ਫਿਰਨ ਵਾਲੀਆਂ ਬਹੁਤ ਸ਼੍ਰੀ ਹਰਿਮੰਦਰ ਸਾਹਿਬ ਸ਼ਹੀਦਾਂ ਵਾਲੇ ਅਤੇ ਸ਼ੀਤਲਾ ਮੰਦਰ ਇਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਇੱਥੇ ਕਿੰਨਾ ਨਹੀਂ ਹੈਗੀਆਂ ਇੱਥੇ ਆਉਣ ਜਾਣ ਦੀ ਕੋਈ ਮੁਸ਼ਕਲ ਨਹੀਂ ਹੈਗੀ ਇੱਥੇ ਅਸੀਂ ਕਿੰਨਾ ਨਹੀਂ ਘਰੋਂ ਨਿਕਲਦੇ ਸਾਰ ਹੀ ਸਾਨੂੰ ਈ ਰਿਕਸ਼ਾ ਮਿਲ ਜਾਂਦਾ ਈ ਰਿਕਸ਼ਾ 'ਤੇ ਬੱਸ ਸਟੈਂਡ 'ਤੇ ਜਾਂਦੇ ਹਾਂ ਬੱਸ ਸਟੈਂਡ ਤੋਂ ਬੱਸ 'ਚ ਬਹਿੰਦੇ ਹਾਂ ਫੇਰ ਅਸੀਂ ਚਲ ਜਾਂਦੇ ਹਾਂ ਅੱਗੇ ਬਹੁਤ ਸਹੂਲਤਾਂ ਵਾ ਸਾਨੂੰ ਪੈਰ ਪੈਰ 'ਤੇ ਮਤਲਬ ਬਹੁਤ ਜ਼ਿਆਦਾ ਸਹੂਲਤਾਂ ਇੱਥੇ ਕੋਈ ਕਮੀ ਨਹੀਂ ਹੈਗੀ ਇੱਥੇ ਜਿਹੜੇ ਜ ਜਗ੍ਹਾ ਐਨੀਆਂ ਸੋਹਣੀਆਂ ਵੇਖਣ ਵਾਲੀਆਂ ਕੋਈ ਹਿਸਾਬ ਨਹੀਂ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆ ਦਰਸ਼ਨ ਕਰਨ ਹਰਿਮੰਦਰ ਸਾਹਿਬ ਸ਼ਹੀਦਾਂ ਵਾਲੇ ਹੋਰ ਬੜੇ ਸਾਰੇ ਕਿੰਨਾ ਨਹੀਂ ਹੈ ਵਾ ਗੁਰਦੁਆਰੇ ਤੀ ਬ ਤੀਰਥ ਉਹ ਵਾਲਾ ਤੀਰਥ ਹੈਗਾ ਤੀਰਥ ਮੇਲਾ ਲੱਗਦਾ ਇੱਥੇ ਬਹੁਤ ਜ਼ਿਆਦਾ ਕਿੰਨਾ ਨਹੀਂ ਹੈਗਾ ਅਸੀਂ ਤਾਂ ਦੇਖਦੇ ਰਹਿੰਦੇ ਹਾਂ ਅਸੀਂ ਰਹਿੰਦੇ ਪੰਜਾਬ ਦੇ ਵਿੱਚ ਹਾਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਘੁੰਮਣ ਫਿਰਨ ਦਾ ਬਹੁਤ ਸ਼ੌਕ ਆ ਅਤੇ ਜਾਂਦੇ ਵੀ ਹਾਂ ਅਸੀਂ ਕਿੰਨਾ ਨਹੀਂ ਸਾਰੇ ਪਾਸੇ ਜਿੱਥੇ ਮਰਜ਼ੀ ਜਾਓ ਬੱਸਾਂ ਦੀ ਬਹੁਤ ਹੈ ਪੈਰ ਪੈਰ 'ਤੇ ਬੱਸ ਫਰੀ ਆ ਬੱਸ ਵੀ ਹੈਗੀ ਆ ਕੋਈ ਕਿਰਾਇਆ ਨਹੀਂ ਕੋਈ ਕੁਛ ਨਹੀਂ ਅਤੇ ਫਰੀ ਲੈ ਕੇ ਜਾਂਦੇ ਫਰੀ ਛੱਡ ਕੇ ਜਾਂਦੇ ਆ ਅਤੇ ਇੱਥੇ ਆਟੋ ਰਿਕਸ਼ਾ ਬਹੁਤ ਆ ਹੈਗੀਆਂ ਸਟੇਸ਼ਨ 'ਤੇ ਚੱਲ ਜਾਓ ਉੱਥੇ ਕਿੰਨਾ ਨਹੀਂ ਕੋਈ ਮੁਸ਼ਕਲ ਨਹੀਂ ਹੈਗੀ ਸਾਨੂੰ ਮਿੰਟੋਂ ਮਿੰਟ ਦੇ ਵਿੱਚ ਜਿੱਥੇ ਬ ਬੱਸ ਮਿਲ ਜਾਂਦੀ ਹੈ ਪੰਜ ਮਿੰਟ ਨਹੀਂ ਲੱਗਦੇ ਪੰਜ ਪੰਜ ਮਿੰਟ ਦੀ ਸਰਵਿਸ ਹੁੰਦੀ ਜਿੱਥੇ ਮਰਜ਼ੀ ਜਾਓ ਕਿੰਨਾ ਨਹੀਂ ਕੋਈ ਨਹੀਂ ਮੁਸ਼ਕਲ ਹੈਗੀ ਕਿੰਨਾ ਨਹੀਂ ਇਹ ਵਾ ਵੀ ਜਗ੍ਹਾ ਬਹੁਤ ਵਧੀਆ ਵੇਖਣ ਵਾਲੀਆਂ ਬਹੁਤ ਸਹੂਲਤਾਂ ਪਹਿਲਾਂ ਹੁੰਦੀਆਂ ਸੀ ਮੁਸ਼ਕਲਾਂ ਵੀ ਬੜਾ ਮੁਸ਼ਕਲ ਹੁੰਦਾ ਰਹੇ ਕੋਈ ਰਿਕਸ਼ਾ ਮਿਲ ਜਾਵੇ ਕਿਤੇ ਹੀ ਹੈ ਜੇ ਮਿਲ ਜਾਵੇ ਜਾਂ ਆਟੋ ਜਾਂ ਬੱਸ ਬਹੁਤ ਮੁਸ਼ਕਲ ਸੀ ਹੁਣ ਤਾਂ ਬਹੁਤ ਸਹੂਲਤਾਂ ਹੋ ਗਈ ਦੀਆਂ ਸਾਡੇ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਫਾਇਦਾ ਵਾ ਇੱਥੇ ਰਹਿਣ ਦਾ ਬਹੁਤ ਵਧੀਆ ਜਗ੍ਹਾ ਵਾ ਦੂਰੋਂ ਦੂਰੋਂ ਲੋਕ ਆਉਂਦੇ ਆ ਘੁੰਮਣ ਇੱਥੇ ਬੜੇ ਖੁਸ਼ ਹੁੰਦੇ ਆ ਰਹਿਣ ਸਹਿਣ ਦਾ ਖਾਣ ਪੀਣ ਦਾ ਬਹੁਤ ਵਧੀਆ ਇੱਥੇ ਪ੍ਰੋਗਰਾਮ ਚੱਲਦਾ ਸ ਬੱਸਾਂ 'ਚ ਬਹੁਤ ਜ਼ਿਆਦਾ ਹੋਰ ਕੀ